ਅਜੋਕੇ ਸਮੇਂ ਵਿੱਚ ਹਰ ਇਨਸਾਨ ਇੰਨਾ ਕੁ ਵਿਅਸਤ ਹੋ ਗਿਆ ਹੈ ਕਿ ਉਹ ਹਰ ਚੀਜ਼ ਨੂੰ ਔਨਲਾਈਨ ਤਰੀਕੇ ਨਾਲ ਖਰੀਦਣਾ ਚਾਹੁੰਦਾ ਹੈ ਪਿਛਲੇ ਕੁਛ ਦਿਨਾਂ ਵਿੱਚ ਮੈਂ ਵੀ ਇਸ ਚੀਜ਼ ਨੂੰ ਪਹਿਲ ਦਿੱਤੀ ਅਤੇ ਮੈਂ ਔਨਲਾਈਨ ਮੋਬਾਈਲ ਫੋਨ ਖਰੀਦਿਆ ਜਿਹਦੇ ਤੋਂ ਮੇਰਾ ਬਹੁਤ ਹੀ ਸਕਾਰਾਤਮਕ ਤਜ਼ਰਬਾ ਰਿਹਾ ਜਦੋਂ ਮੈਂ ਉਹਨੂੰ ਔਡਰ ਕੀਤਾ ਤਾਂ ਮੈਨੂੰ ਪਹਿਲਾਂ ਡਰ ਸੀ ਕਿ ਕਿਤੇ ਕੋਈ ਮੇਰੇ ਨਾਲ ਕੋਈ ਇਸ ਤਰ੍ਹਾਂ ਦਾ ਕੰਮ ਨਾ ਹੋ ਜਾਵੇ ਕਿ ਜਿਹਦੇ ਕਰਕੇ ਮੈਨੂੰ ਮੁੜ ਕੇ ਪਛਤਾਉਣਾ ਪੈ ਜੇ ਬਟ ਜਦੋਂ ਮੈਂ ਔਨਲਾਈਨ ਔ ਫੋਨ ਔਡਰ ਕੀਤਾ ਤਾਂ ਮੈਨੂੰ ਮੇਰਾ ਤਜ਼ਰਬਾ ਬਹੁਤ ਹੀ ਵਧੀਆ ਰਿਹਾ ਮੈਂ ਉੱਥੇ ਔਡਰ ਕੀਤਾ ਮੇਰਾ ਮੋਬਾਈਲ ਫੋਨ ਓਪੋ ਰੈਨੋ ਟੈਂਨ ਪ੍ਰੋ ਸੀ ਅਤੇ ਉਹਨੂੰ ਮੈਂ ਔਡਰ ਕੀਤਾ ਫਲਿੱਪਕਾਟ ਤੋਂ ਮੰਗਵਾਇਆ ਅਤੇ ਉਹਦੀ ਡਿਲੀਵਰੀ ਵੀ ਮੈਨੂੰ ਦੋ ਦਿਨਾਂ ਦੇ ਵਿੱਚ ਹੋ ਗਈ ਉਹ ਅੰਮ੍ਰਿਤਸਰ ਦੇ ਹੀ ਰਣਜੀਤ ਐਵਨਿਊ ਦੇ ਉਹਨਾਂ ਦੇ ਦਫਤਰ ਹੈ ਜਿੱਥੇ ਜਾ ਕੇ ਮੈਂ ਉੱਥੋਂ ਉਹਨਾਂ ਨੂੰ ਖਰੀਦਿਆ ਅਤੇ ਉੱਥੋਂ ਦਾ ਜਿਹੜਾ ਸਟਾਫ ਹੈ ਉੱਥੋਂ ਦੇ ਲੋਕ ਵੀ ਇੰਨੇ ਚੰਗੇ ਸਨ ਉਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਇਸ ਸਮ ਮੋਬਾਇਲ ਬਾਰੇ ਸਾਰੀ ਨੌਲੇਜ ਦਿੱਤੀ ਅਤੇ ਅੱਗੋਂ ਵੀ ਜਿਸ ਤਰ੍ਹਾਂ ਮੋਬਾਈਲ ਦੀ ਕੁਛ ਇਸ ਤਰ੍ਹਾਂ ਦੇ ਫੰਕਸ਼ਨ ਤਾਂ ਜਿਨ੍ਹਾਂ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਕੇ ਮੇਰੇ ਪੁਰਾਣੇ ਫੋਨ ਦੇ ਵਿੱਚੋਂ ਸਾਰੀਆਂ ਨਵੀਆਂ ਤਕਨੀਕਾਂ ਸਮਝਾਈਆਂ ਕਿ ਜਿਹੜੀਆਂ ਮੈਨੂੰ ਇਸ ਮੋਬਾਈਲ 'ਚ ਦੋਵਾਂ ਦਾ ਆਪਸ ਵਿੱਚ ਸੰਬੰਧ ਸਮਝਾਇਆ ਕਿ ਕੀ ਪੁਰਾਣੇ ਫੋਨ ਦੇ ਵਿੱਚ ਜਿਹੜਾ ਮੇਰਾ ਨਹੀਂ ਸੀ ਅਤੇ ਨਵੇਂ ਫੋਨ ਵਿੱਚ ਹੈ ਪਰ ਮੈਨ ਮੈਨੂੰ ਔਨਲਾਈਨ ਚੀਜ਼ਾਂ ਮੰਗਵਾ ਕੇ ਬਹੁਤ ਹੀ ਖੁਸ਼ੀ ਮਿਲੀ ਅਤੇ ਮੈਂ ਅੱਗੇ ਤੋਂ ਵੀ ਸਭ ਨੂੰ ਇਹੀ ਸਲਾਹ ਦੇਵਾਂਗੀ ਕਿ ਜਿਹੜੀਆਂ ਤੁਹਾਡੀਆਂ ਵਧੀਆ ਐਪਸ ਨੇ ਚੰਗੀਆਂ ਐਪਸ ਨੇ ਉਹਨਾਂ ਤੋਂ ਤੁਸੀਂ ਹਰ ਚੀਜ਼ਾਂ ਨੂੰ ਔਡਰ ਕਰੋ ਅਤੇ ਸਾਰਿਆਂ ਨੂੰ ਆਪਣੇ ਲਾਗੇ ਤਾਗੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਜ਼ਦੀਕੀ ਸੰਬੰਧਿਤ ਰੱਖਦੇ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿਉ ਤਾਂ ਕਿ ਉਹ ਵੀ ਔਨਲਾਈਨ ਚੀਜ਼ਾਂ ਮੰਗਵਾਉਣ ਅਤੇ ਵੱਧ ਤੋਂ ਵੱਧ ਲਾਹਾ ਲੈ ਸਕਣ ਧੰਨਵਾਦ